ਮੈਨੂੰ ਰਸੋਈ ਵਿੱਚ ਖਾਣਾ ਬਣਾਉਣਾ ਬਹੁਤ ਜ਼ਿਆਦਾ ਹੀ ਪਸੰਦ ਹੈ ਮੈਂ ਜਦੋਂ ਵੀ ਖਾਣਾ ਬਣਾਉਂਦੀ ਹਾਂ ਤਾਂ ਹਰ ਇੱਕ ਚੀਜ਼ ਚੰਗੇ ਤਰੀਕੇ ਨਾਲ਼ ਦੇਖਦੀ ਹਾਂ ਸਭ ਕੁਛ ਪਰਖਦੀ ਹਾਂ ਅਤੇ ਫਿਰ ਖਾਣਾ ਬਣਾਉਣਾ ਸ਼ੁਰੂ ਕਰਦੀ ਹਾਂ ਮੈਂ ਹ ਖਾਣਾ ਬਣਾਉਣ ਵਾਲੀ ਜਗ੍ਹਾ ਨੂੰ ਬਹੁਤ ਹੀ ਸਾਫ ਰੱਖਦੀ ਹਾਂ ਸਵੇਰ 'ਤੇ ਬਹੁਤ ਹੀ ਚੰਗੇ ਤਰੀਕੇ ਨਾਲ ਸਭ ਕੁਛ ਕਰਦੀ ਹਾਂ ਅਤੇ ਵਿਚਾਰ ਸਾਂਝੇ ਕਰਨ ਦੀ ਗੱਲ ਕਰਾਂ ਤਾਂ ਜਿਵੇਂ ਮੇਰੀ ਛੋਟੀ ਭੈਣ ਹੈ ਉਹ ਮੇਰੇ ਤੋਂ ਹੀ ਸਭ ਕੁਛ ਸਿੱਖਦੀ ਹੈ ਉਹ ਮੇਰੇ ਤੋਂ ਹੀ ਸਿੱਖਦੀ ਹੈ ਕਿ ਕੋਈ ਚੀਜ਼ ਕਿਵੇਂ ਬਣਾਉਣੀ ਹੈ ਜਾਂ ਕਿਵੇਂ ਕੁਛ ਕਰਨਾ ਹੈ ਤਾਂ ਮੈਂ ਉਸਨੂੰ ਦੱਸਦੀ ਹਾਂ ਕਿ ਸ ਸਭ ਤੋਂ ਪਹਿਲਾ ਰਸੋਈ ਵਿੱਚ ਆਉਣ ਤੋਂ ਪਹਿਲਾਂ ਹੱਥ ਧੋਣੇ ਜ਼ਰੂਰੀ ਹਨ ਗੈਸ ਨੂੰ ਦੇਖਣਾ ਜ਼ਰੂਰੀ ਹੈ ਜਾਂ ਗੈਸ ਸਿਲੰਡਰ ਦੇਖਣਾ ਜ਼ਰੂਰੀ ਹੈ ਅਤੇ ਇੱਕ ਸਭ ਤੋਂ ਜ਼ਰੂਰੀ ਹੈ ਕਿ ਖਾਣਾ ਬਣਾਉਣ ਵਾਲੀ ਜਗ੍ਹਾ ਸਾਫ ਹੋਵੇ ਤਾਂ ਹੀ ਤਾ ਤਾਂ ਸਾਡਾ ਸਰੀਰ ਸਾਫ ਰਹਿ ਸਕਦਾ ਹੈ ਅਤੇ ਖਾਣਾ ਸਾਫ ਬਣੇਗਾ ਅਤੇ